ਮੈਂ ਸਵੇਰੇ ਸ਼ਾਮ ਰਨਿੰਗ ਕਰਦੀ ਹਾਂ ਜਿਸ ਨਾਲ ਮੈਂ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਬੈਨੀਫਿਟ ਹਾਂ ਰਨਿੰਗ ਕਰਨਾ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਸਾਨੂੰ ਸਵੇਰੇ ਸਾਨੂੰ ਸਵੇਰੇ ਸ਼ਾਮ ਰਨਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਸਾਡੀਆਂ ਸਾਡ ਸਾਡੇ ਅੰਦਰ ਲੱਗੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ ਅਤੇ ਅਸੀਂ ਫਿਟਨੈਸ ਫੀਲ ਕਰਦੇ ਹਾਂ ਮੈਂ ਹਰ ਰੋਜ਼ ਸਵੇਰੇ ਉੱਠ ਕੇ ਰਨਿੰਗ ਕਰਨ ਜਾਂਦੀ ਹਾਂ ਰਨਿੰਗ ਕਰਦੀ ਹਾਂ ਮੈਂ ਬੂਟ ਪਾ ਕੇ ਰਨਿੰਗ ਕਰਦੀ ਹਾਂ ਬਿਕੋਸ ਬੂਟ ਪਾਉਣ ਨਾਲ ਮੈਨੂੰ ਭੱਜਣ ਵਿੱਚ ਆਸਾਨੀ ਹੁੰਦੀ ਹੈ ਅਤੇ ਇਹ ਸਾਡੇ ਸ ਰਨਿੰਗ ਕਰਨਾ ਸਾਡੇ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਇਸ ਨਾਲ ਸੋ ਸਾਡੀਆਂ ਕਾਫੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਅਤੇ ਸਾਨੂੰ ਰਨਿੰਗ ਕਰਦੇ ਸਮੇਂ ਲੰਬੇ ਸਾਹ ਲੈਣੇ ਚਾਹੀਦੇ ਹਨ